ਹਾਂਜੀ ਮੈਂ ਬਹੁਤ ਸਾਰੇ ਬੀਮਾ ਨਾ ਏਜੈਂਟਾਂ ਨਾਲ ਗੱਲਬਾਤ ਕੀਤੀ ਹੈ ਜਿਵੇਂ ਕਿ ਵੱਖ ਵੱਖ ਕੰਪਨੀਆਂ ਦੇ ਵੱਖ ਵੱਖ ਬੀਮਾਂ ਏਜੰਟ ਐਲ ਈ ਸੀ ਦਾ ਆਈ ਸੀ ਆਈ ਸੀ ਦਾ ਐਚ ਡੀ ਐਫ ਸੀ ਦਾ ਐਸ ਬੀ ਆਈ ਦਾ ਪਰ ਮੈਨੂੰ ਇਹਨਾਂ ਦੇ ਵਿੱਚੋਂ ਸਭ ਤੋਂ ਜਿਆਦਾ ਵਧੀਆ ਬੀਮਾ ਏਜੰਟ ਜੋ ਕਿ ਪੋਲਸੀਆਂ ਬਾਰੇ ਦੱਸਦਾ ਹੈ ਐਲ ਆਈ ਸੀ ਦਾ ਲੱਗਿਆ ਅਤੇ ਮੈਂ ਉਸ ਤੋਂ ਵੱਖ ਵੱਖ ਤਰ੍ਹਾਂ ਦੀਆਂ ਪੋਲਸੀਆਂ ਦੇ ਬਾਰੇ ਜਾਣਕਾਰੀ ਲਈ ਅਤੇ ਸਮਝਣ ਦੀ ਕੋਸ਼ਿਸ਼ ਕੀਤੀ ਐਲ ਆਈ ਸੀ ਦੇ ਏਜੰਟ ਨੇ ਮੈਨੂੰ ਇਹਨਾਂ ਪੋਲਸੀਆਂ ਬਾਰੇ ਬਹੁਤ ਹੀ ਬਾ ਖੂਬੀ ਨਾਲ ਸਮਝਾਇਆ ਅਤੇ ਇਸ ਦੇ ਫਾਇਦੇ ਅਤੇ ਨੁਕਸਾਨ ਬਾਰੇ ਦੱਸਿਆ ਮੈਂ ਜਿਵੇਂ ਕਿ ਐਲ ਆਈ ਸੀ ਦੀ ਪੋਲਸੀ ਪੈਨਸ਼ਨ ਸਕੀਮ ਲਈ ਜਿਸ ਵਿਚ ਮੈਨੂੰ ਲਗਾਤਾਰ ਪੰਦਰਾ ਸਾਲ ਪੇਮੈਂਟ ਦੇਣੀ ਪਵੇਗੀ ਤੇ ਉਸ ਪੰਦਰਾ ਸਾਲਾਂ ਤੋਂ ਬਾਅਦ ਮੇਰੇ ਪੈਨਸ਼ਨ ਲੱਗ ਜਾਵੇ ਜਿੰਨੀ ਮੈਂ ਪੇਮੈਂਟ ਸਲਾਨਾ ਕਰ ਰਿਹਾ ਉਨੀ ਹੀ ਮੇਰੀ ਪੈਨਸ਼ਨ ਲੱਗ ਜਾਵੇ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਪੋਲਸੀਆਂ ਬਾਰੇ ਮੈਂ ਉਸ ਤੋਂ ਸਮਝਿਆ ਅਤੇ ਹੋਰ ਕਈ ਪੋਲਸੀਆਂ ਨੂੰ ਮੈਂ ਉਸ ਤੋਂ ਲਿਆ ਜਿਵੇਂ ਕਿ ਜੀਵਨ ਬੀਮਾ ਉਮੰਗ ਵਰਗੀਆਂ ਪੋਲਿਸੀਆਂ ਨੂੰ ਵੀ ਮੈਂ ਪਰਚੇਜ ਕੀਤਾ ਜੋ ਕਿ ਮੈਨੂੰ ਬਹੁਤ ਵਧੀਆ ਲੱਗੀਆਂ ਇਸ ਦੇ ਵਿੱਚ ਲਾਈਫ ਦਾ ਕਵਰ ਵੀ ਬਹੁਤ ਜਿਆਦਾ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਐਲ ਆਈ ਸੀ ਵੱਲੋਂ ਇਹਨਾਂ ਪਲੈਨ ਨੂੰ ਤਿਆਰ ਕੀਤਾ ਗਿਆ ਹੈ ਐਲ ਆਈ ਸੀ ਵੱਲੋਂ